ਜੋ ਲੋਕੀ ਦੇਖ ਨਹੀਂ ਸਕਦੇ ਦ੍ਰਿਸ਼ਟੀਹੀਣ ਹਨ ਉਹਨਾਂ ਨੂੰ ਟੈਕਨੋਲੋਜੀ ਵਰਤਣ ਲਈ ਵੀ ਮਾਈ ਆਈਜ ਐਪ ਜੋ ਕਿ ਡੈਨਿਸ਼ ਦੀ ਇੱਕ ਕੰਪਨੀ ਹੈ ਉਹਨਾਂ ਦੁਆਰਾ ਲਾਂਚ ਕੀਤੀ ਗਈ ਹੈ ਜੋ ਕਿ ਦ੍ਰਿਸ਼ਟੀਹੀਣ ਹਨ ਅਤੇ ਉਹ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਦੇ ਇਸ ਐਪ ਦੇ ਵਿੱਚ ਕਈ ਤਰ੍ਹਾਂ ਦੇ ਫਿਚਰ ਹਨ ਜਿਸ ਕਾਰਨ ਉਹ ਜਿਵੇਂ ਕਿ ਗੂ ਮੋਬਾਈਲ ਐਪ ਦੇ ਹੀ ਅਸਿਸਟੈਂਟ ਦੁਆਰਾ ਬੋਲ ਕੇ ਜਾਂ ਕਿਸੇ ਵੀ ਤਰ੍ਹਾਂ ਜਿਸ ਤਰ੍ਹਾਂ ਉਹ ਸਹਿਜ ਹਨ ਉਹ ਕੁਝ ਵੀ ਕਰ ਸਕਦੇ ਹਨ ਉਹ ਟੋਰਚ ਜਲਾ ਸਕਦੇ ਹਨ ਕਿਸੇ ਨੂੰ ਫੋਨ ਕਰ ਸਕਦੇ ਹਨ ਜਾਂ ਕੁਝ ਵੀ ਕਰ ਸਕਦੇ ਹਨ ਇਹ ਇੱਕ ਬਹੁਤ ਹੀ ਚੰਗੀ ਐਪ ਹੈ ਜੋ ਕਿ ਦ੍ਰਿਸ਼ਟੀਹੀਣਾਂ ਦੀ ਬਹੁਤ ਹੀ ਮਦਦ ਕਰ ਰਹੀ ਹੈ ਇਸ ਐਪ ਨੂੰ ਇਸ ਐਪ ਰਾਹੀਂ ਕਿਸੇ ਵੀ ਤਸਵੀਰ ਜਾਂ ਚਿੱਤਰ ਜਾਂ ਫੋਟੋਆਂ ਦਾ ਵਰਣਨ ਵੀ ਕੀਤਾ ਜਾਂਦਾ ਹੈ ਜੇਕਰ ਕੋਈ ਵੀ ਸਮਗਰੀ ਖਰੀਦਣੀ ਹੋਵੇ ਤਾਂ ਵੀ ਇਸ ਐਪ ਤੋਂ ਕੀਤਾ ਜਾ ਸਕਦਾ ਹੈ ਕਿਸੇ ਵੀ ਥਾਂ ਜਾਣਾ ਹੋਵੇ ਕੋਈ ਵੀ ਥਾਂ ਲੱਭਣੀ ਹੋਵੇ ਤਾਂ ਵੀ ਇਹ ਐਪ ਉਸ ਦੀ ਮਦਦ ਕਰ ਸਕਦੀ ਹੈ ਕੁਝ ਵੀ ਪੜ੍ਹਨਾ ਹੋਵੇ ਤਾਂ ਵੀ ਇਹ ਐਪ ਮਦਦ ਕਰ ਸਕਦੀ ਹੈ ਇਹ ਇੱਕ ਬਹੁਤ ਹੀ ਵਧੀਆ ਐਪ ਹੈ ਜੋ ਕਿ ਬ੍ਰਿਧਾਂ ਅਤੇ ਦ੍ਰਿਸ਼ਟੀਹੀਣਾਂ ਦੀ ਮਦਦ ਕਰ ਰਹੀ